ਇਹ ਯਕੀਨੀ ਬਣਾਉਣ ਲਈ ਕਿ ਨਵਜੰਮੇ ਬੱਚਿਆਂ ਨੂੰ ਸਾਫ਼ ਸੁਥਰਾ ਵਾਤਾਵਰਨ ਹੋਵੇ ਅਤੇ ਅਸ਼ੁੱਧ ਸਥਿਤੀਆਂ ਕਾਰਨ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾਵੇ ਕਈ ਮੁੱਖ ਉਪਾਅ ਕੀਤੇ ਜਾਣੇ ਚਾਹੀਦੇ ਹਨ ਪਹਿਲਾ ਬੱਚੇ ਨੂੰ ਸੰਭਾਲਣ ਤੋਂ ਪਹਿਲਾਂ ਵਾਰ ਵਾਰ ਸਾਬਣ ਅਤੇ ਪਾਣੀ ਨਾਲ ਹੱਥ ਧੋ ਕੇ ਸਖਤ ਸਫ਼ਾਈ ਅਭਿਆਸਾਂ ਨੂੰ ਬਣਾਈ ਰੱਖੋ ਬੱਚੇ ਦੇ ਦੁੱਧ ਪਿਲਾਉਣ ਵਾਲੀਆਂ ਬੋਤਲਾਂ ਨਿੱਪਲਾਂ ਅਤੇ ਕਿਸੇ ਵੀ ਖਿਡੌਣੇ ਨੂੰ ਨਿਯਮਤ ਤੋਰ 'ਤੇ ਸੁਰੱਖਿਅਤ ਬੱਚੇ ਦੇ ਅਨੁਕੂਲ ਕਲੀਨਰ ਨਾਲ ਸਾਫ਼ ਅਤੇ ਰੋਗਾਣੂ ਮੁਕਤ ਕਰੋ ਇਹ ਸੁਨਿਸ਼ਚਿਤ ਕਰੋ ਕਿ ਬੱਚੇ ਦੇ ਰਹਿਣ ਵਾਲੇ ਖੇਤਰ ਜਿਸ ਵਿੱਚ ਪੰਘੂੜਾ ਮੇਜ਼ ਬਦਲਣ ਅਤੇ ਖੇਡਣ ਦੇ ਖੇਤਰ ਸ਼ਾਮਲ ਹੈ ਨੂੰ ਗੈਰ ਜ਼ਹਿਰੀਲੇ ਕੀਟਾਣੂ ਨਾਸ਼ਕਾਂ ਦੀ ਵਰਤੋਂ ਕਰਕੇ ਰੋਜ਼ਾਨਾ ਸਾਫ਼ ਕੀਤਾ ਜਾਂਦਾ ਹੈ ਬੱਚੇ ਦੇ ਬਿਸਤਰੇ ਅਤੇ ਕੱਪੜਿਆਂ ਨੂੰ ਹਲਕੇ ਹਾਈਜੈਨਿਕ ਤਰੀਕਿਆਂ ਨਾਲ ਧੋਣਾ ਚਾਹੀਦਾ ਹੈ ਅਤੇ ਨਿਯਮਤ ਤੌਰ 'ਤੇ ਬਦਲਣਾ ਚਾਹੀਦਾ ਹੈ

ਧੂੜ ਜਾਂ ਹੋਰ ਪ੍ਰਦੂਸ਼ਕਾਂ ਦੇ ਸੰਪਰਕ ਤੋਂ ਬਚਾਉਣ ਬਚਣ ਲਈ ਵੀ ਜ਼ਰੂਰੀ ਹੈ ਕੀਟਾਣੂਆਂ ਨੂੰ ਫੈਲਣ ਤੋਂ ਰੋਕਣ ਲਈ ਮਹਿਮਾਨਾਂ ਨੂੰ ਬੱਚੇ ਨੂੰ ਫੜਨ ਤੋਂ ਪਹਿਲਾਂ ਅਤੇ ਹੱਥ ਧੋਣ ਲਈ ਕਿਹਾ ਜਾਣਾ ਚਾਹੀਦਾ ਹੈ ਉੱਚ ਛੂਹਣ ਵਾਲੀਆਂ ਸਤਹ ਜਿਵੇਂ ਕਿ ਦਰਵਾਜ਼ੇ ਦੇ ਹੈਂਡਲ ਅਤੇ ਲਾਈਟ ਸਵਿੱਚ ਨੂੰ ਨਿਯਮਤ ਤੋਰ 'ਤੇ ਰੋਗਾਣੂ ਮੁਕਤ ਕਰੋ ਅੰਤ ਵਿੱਚ ਇਹ ਯਕੀਨੀ ਬਣਾਓ ਕਿ ਡਾਇਪਰ ਅਤੇ ਲਾਗਾਂ ਨੂੰ ਰੋਕਣ ਲਈ ਬੱਚੇ ਦੇ ਡੈਪਰ ਖੇਤਰ ਨੂੰ ਸਾਫ਼ ਅਤੇ ਸੁੱਕਾ ਰੱਖਿਆ ਗਿਆ ਹੈ ਇਨ੍ਹਾਂ ਅਭਿਆਸਾਂ ਨੂੰ ਲਾਗੂ ਕਰਕੇ ਤੁਸੀਂ ਇੱਕ ਸੁਰੱਖਿਅਤ ਸਾਫ਼ ਵਾਤਾਵਰਨ ਬਣਾ ਸਕਦੇ ਹੋ ਜੋ ਬਿਮਾਰੀ ਦੇ ਜੋਖਮ ਨੂੰ ਘੱਟ ਕਰਦਾ ਹੈ ਅਤੇ ਬੱਚੇ ਦੀ ਸਿਹਤ ਅਤੇ ਤੰਦਰੁਸਤੀ ਦਾ ਸਮਰਥਨ ਕਰਦਾ ਹੈ